ਮੈਨੂੰ ਕੈਮਰੇ ਨਾਲ ਬਹੁਤ ਸਾਰੀਆਂ ਤਸਵੀਰਾਂ ਖਿੱਚਣੀਆਂ ਪਸੰਦ ਹਨ ਜਿਵੇਂ ਗੱਲ ਕਰੀਏ ਤਾਂ ਜਾਨਵਰਾਂ ਦੀਆਂ ਤਸਵੀਰਾਂ ਪੰਛੀਆਂ ਦੀਆਂ ਤਸਵੀਰਾਂ ਲੋਕਾਂ ਦੀਆਂ ਫੋਟੋਆਂ ਹੋ ਗਈਆਂ ਕੁਦਰਤ ਨਾਲ਼ ਜੁੜੀਆਂ ਹੋਈਆਂ ਫੋਟੋਆਂ ਹੋ ਗਈਆਂ ਅਤੇ ਆਪਣੀਆਂ ਖੁਦ ਦੀਆਂ ਫੋਟੋਆਂ ਹੋ ਗਈਆਂ ਅਤੇ ਮੈਨੂੰ ਸਭ ਤੋਂ ਜ਼ਿਆਦਾ ਕੁਦਰਤ ਦੀਆਂ ਫੋਟੋਆਂ ਖਿੱਚਣੀਆਂ ਪਸੰਦ ਨੇ ਕਿ ਉਹਦੇ ਨਾਲ਼ ਸਾਨੂੰ ਅਹਿਸਾਸ ਹੁੰਦਾ ਏ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਹਾਂ ਅਤੇ ਉਸਦੀਆਂ ਚੀਜ਼ਾਂ ਨੂੰ ਬਰੀਕੀ ਨਾਲ਼ ਨੋਟਿਸ ਕਰਦੀ ਹਾਂ ਅਤੇ ਉਹ ਚੀਜ਼ਾਂ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਨੇ ਅਤੇ ਇਸ ਤੋਂ ਇਲਾਵਾ ਪੰਛੀਆਂ ਪੰਛੀਆਂ ਦੀਆਂ ਫੋਟੋਆਂ ਅਤੇ ਜਿਹੜੀ ਇੱਥੇ ਜਾਨਵਰਾਂ ਦੀਆਂ ਜਿਹੜੀਆਂ ਫੋਟੋਆਂ ਉਹ ਕੁਦਰਤ ਦੇ ਅਲੱਗ ਅਲੱਗ ਜੀਵਾਂ ਨੂੰ ਦੇਖਣ ਦੇ ਵਿੱਚ ਸਾਡੀਆਂ ਮਦਦ ਕਰਦੀਆਂ ਅਤੇ ਅਸੀਂ ਉਹਨਾਂ ਨੂੰ ਬਹੁਤ ਹੀ ਆਸਾਨੀ ਨਾਲ਼ ਫੀਲ ਕਰ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਮੈਨੂੰ ਫੈਮਲੀ ਫੰਕਸ਼ਨਸ ਦੀਆਂ ਫੰਕਸ਼ਨਸ ਦੀਆਂ ਫੋਟੋਆਂ ਖਿੱਚਣੀਆਂ ਬਹੁਤ ਪਸੰਦ ਨੇ ਅਤੇ ਇਸ ਤੋਂ ਇਲਾਵਾ ਆਪਣੇ ਡੇਲੀ ਲਾਈਫ਼ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਚੱਲਦੇ ਰਹਿੰਦੇ ਨੇ ਜਿਵੇਂ ਸਕੂਲ ਲਾਈਫ਼ ਦੇ ਫੰਕਸ਼ਨ ਹੋ ਗਏ ਆਪਣੇ ਫੈਮਿਲੀ ਫੰਕਸ਼ਨ ਹੋ ਗਏ ਕੋਲੇਜ ਦੇ ਫੰਕਸ਼ਨ ਹੋ ਗਏ ਅਤੇ ਇਸ ਤੋਂ ਇਲਾਵਾ ਆਪਾਂ ਕਿਸੇ ਫਰੈਂਡ ਜਾਂ ਦੋਸਤ ਦੇ ਘਰੇ ਜਾਂਦੇ ਆ ਉਹਦੇ ਘਰੇ ਕੋਈ ਬਰਡੇ ਪਾਰਟੀ ਜਾਂ ਕਿਸੇ ਓਕੇਜ਼ਨ 'ਤੇ ਜਾਂਦੇ ਹਾਂ ਉੱਥੋਂ ਦੀਆਂ ਮੈਨੂੰ ਫੋਟੋਆਂ ਖਿੱਚਣੀਆਂ ਬਹੁਤ ਜ਼ਿਆਦਾ ਪਸੰਦ ਨੇ ਅਤੇ ਇਹ ਸਾਰੀਆਂ ਫੋਟੋਆਂ ਐਜ਼ ਆ ਮੈਮਰੀਜ਼ ਬਹੁਤ ਹੀ ਕੰਮ ਆਉਂਦੀਆਂ ਨੇ ਅਤੇ ਇਹ ਚੀਜ਼ਾਂ ਸਾਨੂੰ ਦੇਖ ਕੇ ਸਕੂਨ ਪ੍ਰਦਾਨ ਕਰਦੀਆਂ ਨੇ ਕਿ ਉਹ ਸਮਾਂ ਕਿੰਨਾ ਖੂਬਸੂਰਤ ਸੀ ਜੋ ਆਪਾਂ ਆਪਣੇ ਫੈਮਲੀ ਨਾਲ਼ ਬਿਤਾਇਆ ਫਰੈਂਡਸ ਦੇ ਨਾਲ਼ ਬਿਤਾਇਆ ਜਾਂ ਕੋਲੇਜ ਦੇ ਫਰੈਂਡਸ ਦੀ ਗੱਲ ਕਰਦੇ ਆ ਜਾਂ ਸਕੂਲ ਦੇ ਫਰੈਂਡਸ ਦੀ ਗੱਲ ਕਰਦੇ ਹਾਂ ਉੱਥੋਂ ਦੇ ਅਧਿਆਪਕਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਮੈਮਰੀਜ਼ ਨੂੰ ਯਾਦ ਕਰਕੇ ਆਪਾਂ ਅਗਲੇ ਪਰਸਨ ਨੂੰ ਉਹਨਾਂ ਬਾਰੇ ਦੱਸਦੇ ਹਾਂ ਕਿ ਆਹ ਪਰਸਨ ਇੱਦਾਂ ਹੁੰਦਾ ਸੀ ਉਹਦੇ ਨਾਲ਼ ਅਸੀਂ ਇੱਦਾਂ ਦਾ ਰਿਲੇਸ਼ਨ ਬਣਾਇਆ ਸੀ ਤਾਂ ਆਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤਾਂ ਮਤਲਬ ਇਹ ਜਿਹੜੀਆਂ ਫੋਟੋਆਂ ਨੇ ਸਾਨੂੰ ਮੈਮਰੀਜ਼ ਕਲੈਕਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀਆਂ ਨੇ